ਹੈਲੋ ਹਾਂਜੀ ਨਮਸਕਾਰ ਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਅਤੇ ਤੁਹਾਨੂੰ ਕੀ ਪ੍ਰੋਬਲਮ ਕੀ ਹੋਈ ਹੈ ਓਕੇ ਠੀਕ ਆ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਕੋਈ ਗੱਲ ਨਹੀਂ ਉਹ ਤਾਂ ਸਾਡੀ ਟਾਈਮਿੰਗ ਹੈਗੀ ਹੈ ਇੱਕ ਸੁਬਾਹ ਛੇ ਵਜੇ ਹੈ ਅਤੇ ਇੱਕ ਅੱਠ ਵਜੇ ਵੀ ਹੈ ਦਸ ਵਜੇ ਵੀ ਹੈ ਉਸ ਤੋਂ ਬਾਅਦ ਦਸ ਵਜੇ ਤੋਂ ਬਾਅਦ ਸ਼ਾਮ ਦੀ ਹੈਗੀਆਂ ਨੇ ਚਾਰ ਵਜੇ ਛੇ ਵਜੇ ਅੱਠ ਵਜੇ ਤੁਹਾਨੂੰ ਜਿਹੜੀ ਸੂਟੇਬਲ ਲੱਗੇਗੀ ਤੁਸੀਂ ਮੈਨੂੰ ਦੱਸ ਦਿਓ ਮੈਂ ਉਸ ਅਕੋਰਡਿੰਗ ਤੁਹਾਡੀ ਟਾਈਮ ਸੈਟਿੰਗ ਵੀ ਕਰ ਦਾਂਗੀ ਅਤੇ ਉਸ ਅਕੋਰਡਿੰਗ ਹੀ ਪੇਮੈਂਟ ਵੀ ਕਰ ਲੈਂਦੇ ਹਾਂ ਫਰੀ ਹੁੰਦੇ ਹੋ ਹਾਂਜੀ ਹਾਂਜੀ ਤੁਹਾਨੂੰ ਨਾ ਦੋ ਟਾਈਮ ਤਾਂ ਕਰਨਾ ਹੀ ਪਏਗਾ ਮਾਰਨਿੰਗ ਵੀ ਇਵਨਿੰਗ ਵੀ ਇੱਕ ਇੱਕ ਸ਼ਿਫਟ ਜਿਹੜੀ ਤੁਹਾਨੂੰ ਸੂਟੇਬਲ ਲੱਗਦੀ ਹੈ ਮੈਨੂੰ ਟਾਈਮਿੰਗ ਦੱਸ ਦਿਓ ਉਸ ਅਕੋਰਡਿੰਗ ਮੈਂ ਤੁਹਾਨੂੰ ਕਰ ਦਾਂਗੀ ਛੇ ਵਜੇ ਕਰ ਲਓ ਇੱਕ ਹਾਂਜੀ ਇੱਕ ਤੁਸੀਂ ਛੇ ਪੰਜ ਵਜੇ ਦੀ ਠੀਕ ਹੈ ਕੋਈ ਗੱਲ ਨਹੀਂ ਪੰਜ ਵਜੇ ਦੀ ਕਰ ਦਾਂਗੇ ਸੈਟਿੰਗ ਹਾਂਜੀ ਠੀਕ ਹੈ ਚਲੋ ਉਸ ਤੋਂ ਪਹਿਲਾਂ ਤੁਸੀਂ ਨਾ ਖਾਇਆ ਪੀਆ ਨਾ ਹੋਵੇ ਯੋਗਾ ਤੋਂ ਪਹਿਲਾਂ ਮੋਰਨਿੰਗ ਤਾਂ ਚਲੋ ਹੋ ਜਾਂਦਾ ਈਵਨਿੰਗ ਤੁਸੀਂ ਅਗਰ ਲੈਣਾ ਤਾਂ ਸਿਕਸ ਓ ਕਲੋਕ ਤੋਂ ਪਹਿਲਾਂ ਪਹਿਲਾਂ ਤੁਸੀਂ ਖਾ ਪੀ ਲੈਣਾ ਹਲਕਾ ਜ਼ਿਆਦਾ ਤੋਂ ਜ਼ਿਆਦਾ ਵੀ ਯੋਗਾ ਕਰਨੀ ਹੈ ਨਾ ਫਿਰ ਉਸ ਅਕੋਰਡਿੰਗ ਤੁਸੀਂ ਹਲਕਾ ਫੁਲਕਾ ਹੀ ਖਾਣਾ ਅਤੇ ਫਿਰ ਤੁਹਾਨੂੰ ਸਾਡੀ ਆਨਲਾਈਨ ਪੇਮੈਂਟ ਵੀ ਆਨਲਾਈਨ ਐਡਵਾਂਸ ਹੁੰਦੀ ਹੈ ਅਤੇ ਉਹ ਥਾਊਜੈਂਟ ਹੋਏਗੀ ਨਹੀਂ ਨਹੀਂ ਇੱਕ ਹਜ਼ਾਰ ਮੰਨਥਲੀ ਫੀਸ ਇੱਕ ਹਜ਼ਾਰ ਹਾਂਜੀ ਕੋਈ ਨਹੀਂ ਉਹ ਤੁਹਾਡੇ ਦੂਰ ਹੋ ਜਾਏਗੀ ਸਾਨੂੰ ਦੋ ਦਿਨ ਡੈਮੋ ਦੇ ਵੀ ਦੇਵਾਂਗੇ ਉਸ ਤੋਂ ਬਾਅਦ ਤੁਸੀਂ ਆਨਲਾਈਨ ਪੇਮੈਂਟ ਕਰਨੀ ਹੋਏਗੀ ਹਰ ਡੇ ਤੁਸੀਂ ਕਲਾਸ ਲਗਾਉਣੀ ਹੈਗੀ ਤਾਂ ਤੁਸੀਂ ਫਿਰ ਆਨਲਾਈਨ ਫੀਸ ਕਰਕੇ ਫਿਰ ਕਰਨੀ ਹੋਏਗੀ

ਹਾਂਜੀ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਠੀਕ ਹਾਂਜੀ ਤੁਸੀਂ ਮੈਨੂੰ ਇੱਕ ਵਾਰੀ ਨਾ ਤੁਸੀਂ ਰਮਾਇਡ ਕਰਵਾ ਦੇਣਾ ਆਨਲਾਈਨ ਤੁਸੀਂ ਕਿੰਨੇ ਵਜੇ ਕਰਵਾਉਣਾ ਇਸ ਮੋਰਨਿੰਗ ਤੋਂ ਹੀ ਕਰਨਾ ਉਸ ਤੋਂ ਬਾਅਦ ਤੋਂ ਸਿਕਸ ਓ ਕਲੋਕ ਤੋਂ ਜੀ ਫਿਰ ਮੈਂ ਹੁਣੇ ਤੁਹਾਡਾ ਨੰਬਰ ਐਡ ਕਰ ਦਿੰਦੀ ਹਾਂ ਨਾ ਅਤੇ ਤੁਸੀਂ ਸੁਬਹਾ ਸਿਕਸ ਓ ਕਲੋਕ ਇੱਕ ਤਾਂ ਕਰ ਲੈਣਾ ਛੇ ਵਜੇ ਕਰ ਲੈਣਾ ਇਕ ਸ਼ਾਮ ਨੂੰ ਸੱਤ ਵਜੇ ਦੋ ਦਿਨ ਬਾਅਦ ਦੋ ਦਿਨ ਡੈਮੋ ਲੈ ਲੈਣਾ ਤੁਹਾਨੂੰ ਬੈਟਰ ਲੱਗੇਗਾ ਤੁਸੀਂ ਰੈਗੂਲਰ ਬਣ ਜਾਣਾ ਸਾਡੇ ਕਸਟਮਰ ਠੀਕ ਹੈ ਜੀ ਠੀਕ ਠੀਕ ਹੈ ਜੀ ਓਕੇ ਜੀ